ਬ੍ਰਹਿਮੰਡ ਦਾ ਆਕਾਰ ਅਸੀਮਿਤ ਹੈ ਅਤੇ ਮਨੁੱਖ ਸ਼ੁਰੂ ਤੋਂ ਹੀ ਬ੍ਰਹਿਮੰਡ ਦੀ ਹੋਂਦ ਬਾਰੇ ਜਗਿਆਸੂ ਰਿਹਾ ਹੈ ਅਤੇ ਇਸੇ ਕਾਰਨ ਅੱਜ ਸਾਇੰਸਦਾਨ ਬ੍ਰਹਿਮੰਡ ਦਾ ਅਧਿਐਨ ਕਰਦੇ ਹਨ ਤਾਂ ਜੋ ਪਤਾ ਲਗਾ ਸਕਣ ਕਿ ਬ੍ਰਹਮੰਡ ਕਿਸ ਤਰ੍ਹਾਂ ਹੋਂਦ ਦੇ ਵਿੱਚ ਆਇਆ ਅਤੇ ਉਸ ਤੋਂ ਬਾਅਦ ਬ੍ਰਹਿਮੰਡ ਦੇ ਵਿੱਚ ਜੋ ਸਾਰੀਆਂ ਚੀਜ਼ਾਂ ਹਨ ਉਹ ਕਿਸ ਤਰ੍ਹਾਂ ਬਣੀਆਂ ਤਾਂ ਬ੍ਰਹਿਮੰਡ ਜੋ ਹੈ ਬਹੁਤ ਰਹੱਸਮਈ ਇੱਕ ਚੀਜ਼ ਹੈ ਅਤੇ ਇਸਦੇ ਵਿੱਚ ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਜਿਹਨਾਂ ਬਾਰੇ ਕਿ ਹਜੇ ਸ਼ਾਇਦ ਮਨੁੱਖ ਨੂੰ ਕੁਛ ਪ੍ਰਤੀਸ਼ਤ ਹੀ ਉਹਨਾਂ ਦਾ ਪਤਾ ਚੱਲਿਆ ਹੈ ਜਿੱਦਾਂ ਕਿ ਬਲੈਕ ਹੋਲ ਵਰਮਹੋਲ ਅਤੇ ਗਲੈਕਸੀਆਂ ਆਦਿ ਬਲੈਕ ਹੋਲ ਜੋ ਹੈ ਇੱਕ ਇਸ ਤਰ੍ਹਾਂ ਦਾ ਰੀਜਨ ਹੁੰਦਾ ਹੈ ਬ੍ਰਹਿਮੰਡ ਦੇ ਵਿੱਚ ਜੋ ਕਿ ਸਾਨੂੰ ਬਿਲਕੁਲ ਕਾਲਾ ਜਾਂ ਬਲੈਕ ਨਜ਼ਰ ਆਉਂਦਾ ਹੈ ਅਤੇ ਉਸਦਾ ਕਾਰਨ ਇਹ ਹੁੰਦਾ ਹੈ ਕਿ ਉਸ ਬਲੈਕ ਹੋਲ ਦੇ ਵਿੱਚੋਂ ਜੋ ਰੋਸ਼ਨੀ ਹੈ ਰੋਸ਼ਨੀ ਦੀਆਂ ਕਿਰਨਾਂ ਉਹ ਵੀ ਬਚ ਕੇ ਨਹੀਂ ਜਾ ਸਕਦੀਆਂ ਤੋ ਇਸ ਦੀ ਗਰੈਵਿਟੀ ਜੋ ਹੈ ਇਸਦੀ ਜੋ ਅਟਰੈਕਸ਼ਨ ਹੈ ਖਿੱਚਣ ਸ਼ਕਤੀ ਉਹ ਇੰਨੀ ਜ਼ਿਆਦਾ ਮਜਬੂਤ ਹੁੰਦੀ ਹੈ ਕਿ ਲਾਈਟ ਜਾਂ ਰੋਸ਼ਨੀ ਵੀ ਇਹਦੇ ਵਿੱਚੋਂ ਬਚ ਕੇ ਨਹੀਂ ਨਿਕਲ ਸਕਦੀ ਅਤੇ ਇਸ ਕਰਕੇ ਸਾਡੇ ਕੋਲ ਕਿਸੇ ਤਰ੍ਹਾਂ ਦੀ ਰੋਸ਼ਨੀ ਬਲੈਕ ਹੋਲ ਦੇ ਵਿੱਚੋਂ ਨਹੀਂ ਨਜ਼ਰ ਆਉਂਦੀ ਤਾਂ ਇਸ ਕਰਕੇ ਬਲੈਕ ਹੋਲ ਜੋ ਹੈ ਉਹ ਕਾਲਾ ਨਜ਼ਰ ਆਉਂਦਾ ਹੈ ਇਸ ਤਰ੍ਹਾਂ ਵਰਮ ਹੋਲ ਇੱਕ ਬਹੁਤ ਹੀ ਐਸਾ ਜਗਿਆਸੂ ਭਰਿਆ ਇੱਕ ਕਨਸੈਪਟ ਹੈ ਜਿਸ ਦੇ ਬਾਰੇ ਕਿ ਸਾਇੰਸਦਾਨ ਜੋ ਹਨ ਉਹ ਖੋਜ ਕਰ ਰਹੇ ਹਨ ਕਿਹਾ ਜਾਂਦਾ ਹੈ ਕਿ ਵਰਮ ਹੋਲ ਇੱਕ ਇਸ ਤਰ੍ਹਾਂ ਦੀ ਅਦ੍ਰਿਸ਼ ਟਨਲ ਹੈ ਜੋ ਕਿ ਦੋ ਪੁਆਇੰਟਸ ਬ੍ਰਹਿਮੰਡ ਦੇ ਵਿੱਚ ਹਨ ਉਹਨਾਂ ਦਾ ਸ਼ੋਰਟਕੱਟ ਹੈ ਅਤੇ ਇਸ ਤਰ੍ਹਾਂ ਗਲੈਕਸੀਆਂ ਲੱਖਾਂ ਕਰੋੜਾਂ ਸਿਤਾਰਿਆਂ ਦਾ ਸਮੂਹ ਮਿਲ ਕੇ ਗਲੈਕਸੀ ਜਾਂ ਆਕਾਸ਼ ਗੰਗਾ ਨੂੰ ਬਣਾਉਂਦਾ ਹੈ ਇਸ ਤੋਂ ਇਲਾਵਾ ਡਾਰਕ ਮੈਟਰ ਅਤੇ ਡਾਰਕ ਐਨਰਜੀ ਵਰਗੇ ਕੁਛ ਕਨਸੈਪਟ ਹਨ ਜਿਨ੍ਹਾਂ ਬਾਰੇ ਸਾਇੰਸਦਾਨਾਂ ਨੂੰ ਹਾਲੇ ਕੁਛ ਨਹੀਂ ਪਤਾ ਇਹਨਾਂ ਦੀ ਕਿਸੇ ਤਰ੍ਹਾਂ ਦੀ ਕੋਈ ਵੀ ਐਕਸਪਲੇਨੇਸ਼ਨ ਨਹੀਂ ਹੈ ਹਾਂ ਇਹ ਜ਼ਰੂਰ ਹੈ ਸਾਇੰਸਦਾਨ ਇਹ ਜਾਣਦੇ ਹਨ ਕਿ ਜੇ ਬਲੈਕ ਡਾਰਕ ਐਨਰਜੀ ਜਾਂ ਡਾਰਕ ਮੈਟਰ ਨਾ ਹੋਵੇ ਤਾਂ ਜਿਹੜੀਆਂ ਆਕਾਸ਼ ਗੰਗਾਵਾਂ ਜਾਂ ਗਲੈਕਸੀਆਂ ਹਨ ਉਨ੍ਹਾਂ ਦੀ ਜੋ ਹੋਂਦ ਹੈ ਉਹ ਨਾਮੁਮਕਿਨ ਹੈ ਤਾਂ ਉਹਨਾਂ ਦੀ ਉੱਥੇ ਕਈ ਤਰ੍ਹਾਂ ਦੇ ਫਿਜਿਕਸ ਦੇ ਲੋ ਜੋ ਹਨ ਉਹ ਨਹੀਂ ਚਲਦੇ ਤਾਂ ਉੱਥੇ ਐਕਸਪਲੇਨੇਸ਼ਨ ਸਾਇੰਸਦਾਨਾਂ ਕੋਲ ਕਿਸੇ ਤਰ੍ਹਾਂ ਦੀ ਨਹੀਂ ਹੈ ਤਾਂ ਉਸਨੂੰ ਉਹ ਇੱਕ ਡਾਰਕ ਐਨਰਜੀ ਜਾਂ ਡਾਰਕ ਮੈਟਰ ਦਾ ਨਾਮ ਦੇ ਦਿੰਦੇ ਹਨ